ਮੈਂ ਭਜਨ ਕੀਰਤਨ ਦੀ ਮੈਂਬਰ ਹੈਗੀ ਆਂ ਤੇ ਸਵੇਰੇ ਉੱਠ ਕੇ ਮੈਂ ਅਭਿਆਸ ਕਰਦੀ ਆਂ ਆਪਣੇ ਗੁਰੂ ਜੀ ਕੋਲੋਂ ਕੁਛ ਅਭਿਆਸ ਲਿਆ ਮੈਂ ਸਿੱਖਿਆ ਤੇ ਉਸਦਾ ਅਭਿਆਸ ਕਰਦੀ ਆਂ ਜਿਵੇਂ ਕਿ ਭਜਨ ਲਿਖਣਾ ਉਸਦਾ ਅਭਿਆਸ ਕਰਨਾ ਤੇ ਉਹਨੂੰ ਰੋਜ ਯਾਦ ਕਰਨਾ ਲਿਖਣਾ ਉਹਨੂੰ ਲਿਖ ਕੇ ਫਿਰ ਉਹਨੂੰ ਕਈ ਵਾਰੀ ਯਾਦ ਵੀ ਕਰਨਾ ਤੇ ਯਾਦ ਕਰਕੇ ਫਿਰ ਉਸ ਨੂੰ ਲਿਖਣਾ ਤੇ ਫਿਰ ਯਾਦ ਕਰਨਾ ਤੇ ਜਦੋਂ ਮੈਂ ਯਾਦ ਕਰ ਲੈਦੀ ਉਸ ਤੋਂ ਬਾਅਦ ਫਿਰ ਜਿਹੜੀ ਚੀਜ਼ਾਂ ਦਾ ਮੈਨੂੰ ਮੁਸ਼ਕਲ ਆ ਰਹੀ ਐ ਉਹ ਮੁਸ਼ਕਿਲ ਐਸੇ ਐ ਜੀ ਜਿਵੇਂ ਅੱਜ ਕੱਲ ਨਵੀ ਤਕਨੀਕ ਆ ਰਹੀ ਐ ਨਵੀਂਆਂ ਚੀਜ਼ਾਂ ਆ ਰਹੀਆਂ ਨੇ ਤੇ ਉਹਨਾਂ ਚੀਜ਼ਾਂ ਬਾਰੇ ਕਈ ਵਾਰੀ ਨਹੀਂ ਨੌਲੇਜ ਹੁੰਦੀ ਤੇ ਉਹਨਾਂ ਦਾ ਸਾਹਮਣਾ ਕਰਨਾ ਇੱਕਦਮ ਕਾਫੀ ਔਖਾ ਲੱਗਦਾ ਤੇ ਜਿਵੇਂ ਕਿ ਆਰਗਨ ਪੈਡ ਹੋਗੀ ਜਾਂ ਕੋਈ ਹੋਰ ਨਵਾਂ ਮਜੀਸ਼ਨ ਹੋ ਗਿਆ ਉਹ ਮਜੀਸ਼ਨ ਇਕਦਮ ਸਾਹਮਣੇ ਆਣਾ ਤਾਂ ਉਹਨਾਂ ਬਾਰੇ ਕਾਫੀ ਮੁਸ਼ਕਿਲ ਲੱਗਾ ਜਿਵੇਂ ਕਈ ਵਾਰੀ ਕੋਈ ਬੈਕ ਤੇ ਨਹੀਂ ਬੈਠਾ ਹੁੰਦਾ ਤੇ ਬੈਕ ਵੀ ਦੇਣੀ ਖੁਦੀ ਕਾਫੀ ਮੁਸ਼ਕਿਲ ਲੱਗਦੀ ਉਸ ਟਾਈਮ ਤੇ ਤੇ ਜਿਹੜੀ ਇਹਨਾਂ ਚੀਜ਼ਾਂ ਦੀ ਮੈਨੂੰ ਮੁਸ਼ਕਿਲ ਆ ਰਹੀ ਹੈ